ਬਜ਼ੁਰਗ ਲੋਕਾਂ ਦੀਆਂ ਬਹੁਤ ਸਾਰੀਆਂ ਕਿਸਮ ਦੀਆਂ ਖੇਡਾਂ ਹਨ ਜੇ ਆਪਾਂ ਗੱਲ ਕਰੀਏ ਬਜ਼ੁਰਗ ਮਰਦਾਂ ਦੀ ਤਾਂ ਉਹ ਜਿਹੜੇ ਜ਼ਿਆਦਾਤਰ ਤਾਸ਼ ਖੇਡਦੇ ਹਨ ਉਹ ਸਾਰੇ ਇਕੱਠੇ ਹੋ ਕੇ ਸੱਥ ਵਿੱਚ ਬੈਠ ਜਾਂਦੇ ਹਨ ਉੱਥੇ ਬੈਠ ਕੇ ਆਪਸ ਵਿੱਚ ਤਾਸ਼ ਖੇਡਦੇ ਹਨ ਅਤੇ ਆਪਸ ਵਿੱਚ ਗੱਲਾਂ ਕਰਦੇ ਹਨ ਆਪਸ ਵਿੱਚ ਮਿਲ ਵਰਤ ਕੇ ਰਹਿੰਦੇ ਹਨ ਪੂਰਾ ਪੂਰਾ ਦਿਨ ਜੋ ਹੈ ਆਪਣਾ ਤਾਸ਼ 'ਤੇ ਬਤੀਤ ਕਰਦੇ ਹਨ ਅਤੇ ਫਿਰ ਸ਼ਾਮ ਨੂੰ ਉਹ ਆਪਣੇ ਖੇਤਾਂ ਵਿੱਚ ਚਲੇ ਜਾਂਦੇ ਹਨ ਉੱਥੇ ਜਾ ਕੇ ਮਹਿਫਲ ਲਾਉਂਦੇ ਹਨ ਮਿਲ ਵਰਤ ਕੇ ਬੈਠਦੇ ਹਨ ਸਤਰੰਜ਼ ਖੇਡਦੇ ਹਨ ਅਤੇ ਉਹ ਉਸ ਦੇ ਨਾਲ ਨਾਲ ਸਿਰਫ ਮਨੋਰੰਜਨ ਹੀ ਨਹੀਂ ਕਰਦੇ ਸਗੋਂ ਆਲੇ ਦੁਆਲੇ ਦੇ ਲੋਕਾਂ ਦੀਆਂ ਵੀ ਗੱਲਾਂ ਕਰਦੇ ਹਨ ਜੇ ਆਪਾਂ ਗੱਲ ਕਰੀਏ ਔਰਤਾਂ ਦੀ ਤਾਂ ਔਰਤਾਂ ਦੀਆਂ ਖੇਡਾਂ ਵਿੱਚ ਜ਼ਿਆਦਾਤਰ ਇਹ ਹੈ ਕਿ ਉਹ ਇੱਕ ਇੱਕ ਤਾਂ ਮਹਿਫਲ ਲਗਾ ਕੇ ਬੈਠ ਜਾਂਦੀਆਂ ਹਨ ਜਿਸ ਵਿੱਚ ਉਹ ਇੱਕ ਦੂਜੀ ਨੂੰ ਪਿੰਡ ਵਿੱਚ ਹੋਈਆਂ ਗੱਲਾਂ ਬਾਰੇ ਦੱਸਦੀਆਂ ਹਨ ਉਹ ਸਿਰਫ਼ ਗੱਲਾਂ ਹੀ ਨਹੀਂ ਕਰਦੀਆਂ ਆਪਣੇ ਪੁਰਾਣੇ ਸਮੇਂ ਨੂੰ ਯਾਦ ਕਰਦੀਆਂ ਹਨ ਜਿਨ੍ਹਾਂ ਵਿੱਚ ਕੀ ਹੈ ਕਿ ਉਹਨਾਂ ਸਮਿਆਂ ਵਿੱਚ ਜੋ ਹੈ ਟਾਈਮ ਕਿਸ ਤਰ੍ਹਾਂ ਦਾ ਸੀ ਕਿਸ ਤਰ੍ਹਾਂ ਲੋਕ ਆਪਸ ਵਿੱਚ ਮਿਲ ਵਰਤ ਕੇ ਰਹਿੰਦੇ ਸਨ ਕਿਸ ਤਰ੍ਹਾਂ ਇਕੱਠੇ ਰਹਿੰਦੇ ਸਨ ਕਿਸ ਤਰ੍ਹਾਂ ਖੇਡਦੇ ਸਨ ਉਹਨਾਂ ਦੇ ਟਾਈਮ ਅਤੇ ਅੱਜ ਦੇ ਟਾਈਮ ਵਿੱਚ ਕੀ ਫਰਕ ਹੈ ਇਸ ਤਰ੍ਹਾਂ ਦੀਆਂ ਗੱਲਾਂ ਕਰਦੀਆਂ ਹਨ ਜੇ ਆਪਾਂ ਗੱਲ ਕਰੀਏ ਮਰਦਾਂ ਦੀ ਤਾਂ ਮਰਦ ਸਿਰਫ ਤਾਸ਼ ਹੀ ਨਹੀਂ ਬਲਕਿ ਉਹ ਸ਼ਾਮ ਨੂੰ ਮੋਟਰ 'ਤੇ ਚਲੇ ਜਾਂਦੇ ਹਨ ਉੱਥੇ ਬੈਠ ਕੇ ਆਪਸ ਵਿੱਚ ਮਿਲ ਵਰਤ ਕੇ ਬੈਠਦੇ ਹਨ ਜਿੱਦਾਂ ਸਤਰੰਜ਼ ਖੇਡਦੇ ਹਨ ਆਦਿ ਉਹਨਾਂ ਦੀਆਂ ਖੇਡਾਂ ਹਨ ਜਿਹੜੀਆਂ ਕਿ ਉਹ ਸਿਰਫ ਆਪਣੇ ਮਨੋਰੰਜਨ ਹੀ ਨਹੀਂ ਕਰਦੇ ਬਲਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕਰਦੇ ਹਨ